ਤਰਨ ਤਾਰਨ ਜ਼ਿਲ੍ਹੇ ਵਿੱਚ ਆਵਾਜਾਈ ਦੇ ਮੁੱਖ ਵਿਕਲਪ ਸੜਕਾਂ ਨੇ ਰੇਲਵੇ ਸਟੇਸ਼ਨ ਨੇ ਅਤੇ ਜਨਤਕ ਆਵਾਜਾਈ ਲਈ ਆਟੋ ਰਿਕਸ਼ਾ ਬੱਸਾਂ ਅਤੇ ਉਬਰ ਵੀ ਇੱਥੇ ਚਲਦੀ ਹੈ ਤਰਨ ਤਰਨ ਵਿੱਚ ਸਾਰੇ ਪਾਸੇ ਸੜਕਾਂ ਦਾ ਜਾਲ ਵਿਛਿਆ ਹੋਇਆ ਹੈ ਆਵਾਜਾਈ ਵਾਸਤੇ ਆਦਮੀ ਆਪਣੀ ਲੋੜ ਅਨੁਸਾਰ ਰੇਲਵੇ ਉਬਰ ਅਤੇ ਬੱਸਾਂ ਦਾ ਸਹਾਰਾ ਲੈ ਸਕਦਾ ਹੈ ਆਮ ਆਦਮੀ ਨੂੰ ਇੱਥੇ ਈ ਰਿਕਸ਼ੇ ਵੀ ਸਸਤੇ ਪੈਂਦੇ ਨੇ ਅਤੇ ਬੱਸਾਂ 'ਤੇ ਰੇਲਵੇ ਸਟੇਸ਼ਨ ਰੇਲਵੇ ਵੀ ਆਵਾਜਾਈ ਵਾਸਤੇ ਕਾਫ਼ੀ ਸਸਤੀਆਂ ਚੱਲਦੀਆਂ ਨੇ ਇੱਕ ਸ਼ਹਿਰ ਤੋਂ ਦੂਜੇ ਜਾਣ ਵਾਸਤੇ ਉਹ ਰੇਲਵੇ ਦਾ ਸਹਾਰਾ ਲੈ ਸਕਦਾ ਹੈ ਅਤੇ ਬੱਸਾਂ ਦਾ ਸਹਾਰਾ ਲੈ ਸਕਦਾ ਹੈ ਇੱਥੇ ਹਵਾਈ ਅੱਡੇ ਦੀ ਸਹੂਲਤ ਨਾ ਹੋਣ ਕਰਕੇ ਆਮ ਆਦਮੀ ਜਿਹੜਾ ਹੈ ਰੇਲਵੇ ਰਾਹੀਂ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਵਿੱਚ ਜਾ ਸਕਦਾ ਹੈ ਅਤੇ ਬੱਸਾਂ ਹਰ ਦਸ ਮਿੰਟ 'ਤੇ ਇਥੋਂ ਚੱਲਦੀਆਂ ਨੇ ਜਿਸ ਕਰਕੇ ਉਹ ਕਿਤੇ ਵੀ ਜਾਣਾ ਚਾਹ ਵੇ ਇਥੋਂ ਵੱਖ ਵੱਖ ਸ਼ਹਿਰਾਂ ਵਿੱਚ ਪਹੁੰਚ ਸਕਦਾ ਹੈ ਆਮ ਆਦਮੀ ਨੂੰ ਉਬਰ ਵੀ ਸਸਤੀ ਪੈਂਦੀ ਹੈ ਜੋ ਸ਼ਹਿਰ ਦੇ ਵਿੱਚ ਲਾਗੇ ਬੰਨੇ ਜਾਣ ਵਾਸਤੇ ਉਸ ਨੂੰ ਸਹੀ ਰਹਿੰਦੀ ਹੈ